ਦੇਖੋ ਜਿਹੜਾ ਮੈਂ ਧਰਮ ਮੰਨਦਾ ਉਹ ਹੈਗਾ ਜੀ ਸਿੱਖ ਧਰਮ ਅਤੇ ਸੰਬੰਧਿਤ ਜੇ ਆਪਾਂ ਮਹੱਤਵਪੂਰਨ ਘਟਨਾਵਾਂ ਦੱਸੀਏ ਤਾਂ ਸਿੱਖ ਧਰਮ 'ਚ ਇੱਕ ਨਹੀਂ ਜੀ ਬਹੁਤ ਨੇ ਕਿੰਨੀਆਂ ਸ਼ਹੀਦੀਆਂ ਨੇ ਗੁਰੂ ਸਾਹਿਬਾਂ ਦੇ ਜਨਮ ਦਿਨ ਹੋ ਗਏ ਜੀ ਅਤੇ ਹੋਰ ਵੀ ਕਿੰਨੇ ਹੀ ਇਤਿਹਾਸ ਨੇ ਅਤੇ ਜੇ ਮੈਂ ਕਿਸੇ ਘਟਨਾ ਬਾਰੇ ਗੱਲ ਕਰੂੰਗਾ ਜੇ ਕਹਾਣੀ ਦੱਸੂਗਾ ਅਤੇ ਜਿਵੇਂ ਚਾਰ ਸਾਹਿਬਜ਼ਾਦਿਆ ਦੀ ਜਦੋਂ ਸ਼ਹੀਦੀ ਹੋਈ ਸੀ ਜੀ ਤਾਂ ਉਹਨਾਂ ਦਾ ਇਤਿਹਾਸ ਇਹੀ ਹੈ ਕਿ ਵੱਡੇ ਦੋ ਸਾਹਿਬਜ਼ਾਦੇ ਜੰਗ 'ਚ ਸ਼ਹੀਦ ਹੋਏ ਸੀ ਅਤੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਦੀਵਾਰ 'ਚ ਜਿੰਦਾ ਚਿਣਾ ਦਿੱਤਾ ਗਿਆ ਸੀ ਜੀ ਅਤੇ ਜਦੋਂ ਸ਼ ਉਹਨਾਂ ਦੀ ਸ਼ਹੀਦੀ ਦੇ ਦਿਨਾਂ ਆਉਂਦੇ ਨੇ ਉਦੋਂ ਜੀ ਸਾਰੇ ਪੰਜਾਬ 'ਚ ਇੱਕ ਦੁੱਖ ਦਾ ਇੱਕ ਦੁੱਖ ਨਹੀਂ ਕਹਿ ਸਕਦੇ ਆਪਾਂ ਇੱਕ ਸਭ ਪਾਸੇ ਚੜ੍ਹਦੀ ਕਲਾ ਆਪਾਂ ਕਹਿ ਸਕਦੇ ਹਾਂ ਕਿ ਲੋਕ ਇਹ ਹੁੰਦੇ ਨੇ ਕਿ ਅਸੀਂ ਸਿੱਖ ਧਰਮ ਤੋਂ ਬਿਲੋਂਗ ਕਰਦੇ ਹਾਂ ਸਭ ਪਾਸੇ ਲੰਗਰ ਲੱਗੇ ਹੁੰਦੇ ਨੇ ਸਭ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹੁੰਦੇ ਨੇ ਹਰ ਕੋਈ ਬੰਦਾ ਪਿੰਡਾਂ 'ਚੋਂ ਟਰਾਲੀਆਂ ਭਰ ਭਰ ਕੇ ਗੁਰਦੁਆਰੇ ਤੱਕ ਆਉਂਦੀਆਂ ਨੇ ਜੀ ਫਤਿਹਗੜ੍ਹ ਸਾਹਿਬ ਤੱਕ ਅਤੇ ਇਸ ਬਾਰੇ ਵੀ ਜਦੋਂ ਹੁਣ ਸ਼ਹੀਦੀ ਗੁਰਪੁਰਬ ਲੰਘੇ ਤਾਂ ਅਸੀਂ ਵੀ ਗਏ ਜੀ ਅਸੀਂ ਵੀ ਸਾਰੇ ਕੋਲਜ ਤੋਂ ਆਪਣੇ ਦੋਸਤਾਂ ਨਾਲ ਇਕੱਠੇ ਹੋ ਕੇ ਗਏ ਅਤੇ ਉੱਥੇ ਜਾ ਕੇ ਫਿਰ ਇੱਕ ਜਿਹੜੀ ਬੰਦਾ ਬਹੁਤ ਕੁਛ ਮਹਿਸੂਸ ਕਰਦਾ ਅਸੀਂ ਅਸੀਂ ਉੱਥੇ ਉਹ ਵੀ ਕੀਤਾ ਉੱਥੇ ਜਗ੍ਹਾ ਜਗ੍ਹਾ 'ਤੇ ਲੰਗਰ ਲੱਗੇ ਹੁੰਦੇ ਨੇ ਕ ਹੁਣ ਜਿਵੇਂ ਠੰਡ ਆ ਗਈ ਤਾਂ ਕੋਈ ਲੋਕ ਗਰੀਬਾਂ ਨੂੰ ਸ਼ੋਲਾਂ ਵੀ ਦਿੰਦੇ ਨੇ ਜੀ ਕੱਪੜੇ ਦਿੰਦੇ ਨੇ ਕਈਆਂ ਦੇ ਘਰ ਰਾਸ਼ਨ ਪਾਉਂਦੇ ਨੇ ਕਈਆਂ ਦੇ ਮਕਾਨ ਪੱਕੇ ਕਰ ਦਿੰਦੇ ਨੇ ਪਿੰਡਾਂ 'ਚੋਂ ਪੈਸੇ ਇਕੱਠੇ ਕਰਕੇ ਤਾਂ ਆਪਾਂ ਜੇ ਉਹਦੀ ਕਹਾਣੀ ਦੱਸੀਏ ਤਾਂ ਲੜਾਈਆਂ ਤਾਂ ਹੋਰ ਵੀ ਬਹੁਤ ਹੋਈਆਂ ਨੇ ਜੀ ਸਿੱਖ ਧਰਮ ਤਾਂ ਭਰਿਆ ਪਿਆ ਇਤਿਹਾਸ ਨਾਲ ਇਹ ਤਾਂ ਇੱਕ ਕਿੱਸਾ ਦੱਸਿਆ ਜੀ ਮੈਂ ਕਿ ਜਿਵੇਂ ਆਪਾਂ ਜੇ ਹੁਣ ਗੁਰਪੁਰਬ ਦੀ ਵੀ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪੂਰੇ ਇਕੱਲਾ ਭਾਰਤ ਦੇਸ਼ 'ਚ ਨਹੀਂ ਜੀ ਪੂਰੇ ਦੇਸ਼ 'ਚ ਪੂਰੇ ਦੁਨੀਆਂ 'ਚ ਮਨਾਇਆ ਜਾਂਦਾ ਧੂਮਧਾਮ ਨਾਲ ਕਿਉਂਕਿ ਉਹਨਾਂ ਨੂੰ ਸਾਰੇ ਲੋਕ ਟੀਚਰ ਮੰਨਦੇ ਨੇ ਅਤੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ 'ਤੇ ਅਮਲ ਕਰਦੇ ਨੇ ਅਤੇ ਇੱਕ ਇਹ ਹੋ ਗਿਆ ਜੀ ਹੋਰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੋ ਗਿਆ ਜੀ ਜਦੋਂ ਉਹਨਾਂ ਦਾ ਜਨਮ ਦਿਹਾੜਾ ਹੁੰਦਾ ਉਦੋਂ ਵੀ ਲੋਕ ਪਟਾਕੇ ਵੀ ਚਲਾਉਂਦੇ ਨੇ ਤਾਂ ਐ ਐਹੋ ਜਿਹੇ ਬੜੇ ਜਿਹੜੇ ਇਤਿਹਾਸਿਕ ਕਿੱਸੇ ਨੇ ਉਹ ਸਾਡੇ ਧਰਮ 'ਚ ਹੋਏ ਨੇ ਜੀ